ਪੰਜਾਬੀ ਭਾਸ਼ਾ ਵਿੱਚ ਕੁਝ ਆਮ ਵਾਕਾਂਸ਼ ਜਿਹਨਾਂ ਨੂੰ ਕਿ ਅਸੀਂ ਵਾਕ ਬੋਲਦੇ ਹਾਂ ਜਿਵੇਂ ਅਸੀਂ ਮੈਂ ਕਹਿੰਦੀ ਹਾਂ ਕਿ ਮੈਂ ਅੱਜ ਹਰਿਮੰਦਰ ਸਾਹਿਬ ਜਾਣਾ ਹੈ ਮੈਂ ਅੱਜ ਕੋਲੇਜ ਜਾਣਾ ਹੈ ਇਸ ਤਰ੍ਹਾਂ ਦੇ ਅਸੀਂ ਵਾਕ ਅਸੀਂ ਗੱਲ ਕਰਦੇ ਹਾਂ ਤਾਂ ਉਸ ਨੂੰ ਕੀ ਕਹਿੰਦੇ ਹਨ ਵਾਕਾਂਸ਼ ਕਹਿੰਦੇ ਹਨ ਅਤੇ ਮੁਹਾਵਰੇ ਜੇਕਰ ਅਸੀਂ ਮੁਹਾਵਰੇ ਦੀ ਗੱਲ ਕਰਦੇ ਹਾਂ ਤਾਂ ਮੁਹਾਵਰੇ ਇੱਕ ਮਤਲਬ ਇਸ ਤਰ੍ਹਾਂ ਦਾ ਇੱਕ ਸ਼ਬਦ ਹੈ ਜਿਸ ਦੇ ਰਾਹੀਂ ਅਸੀਂ ਇੱਕ ਵੱਡੀ ਗੱਲ ਨੂੰ ਕਿ ਮਤਲਬ ਜਿਵੇਂ ਕਿ ਜਿਵੇਂ ਕਹਿ ਸਕਦੇ ਹਾਂ ਕਿ ਕਿਸੇ ਨੂੰ ਇੱਕ ਕੋਈ ਚੀਜ਼ ਹੈ ਉਸਨੂੰ ਪਸੰਦ ਕਰਨ ਵਾਲੇ ਬਹੁਤ ਜਾਣੇ ਹਾਂ ਹਨ ਅਤੇ ਆਪਾਂ ਉਸਨੂੰ ਉਸ ਨੂੰ ਇੱਕ ਮੁਹਾਵਰੇ ਵਿੱਚ ਅਗਰ ਕਿਸੇ ਨੂੰ ਕਹਿਣਾ ਹੋਵੇ ਜਾਂ ਸਮਝਾਉਣਾ ਹੋਵੇ ਤਾਂ ਆਪਾਂ ਇਹ ਅਖਾਣ ਯੂਜ ਕਰਦੇ ਹਾਂ ਇੱਕ ਅਨਾਰ ਸੌ ਬਿਮਾਰ ਇਹਨੂੰ ਅਸੀਂ ਕੀ ਕਹਿੰਦੇ ਹਾਂ ਇਸਨੂੰ ਅਸੀਂ ਮੁਹਾਵਰੇ ਕਹਿੰਦੇ ਹਾਂ ਇਸੇ ਕਰਕੇ ਮੁਹਾਵਰੇ ਮ ਮੁਹਾਵਰਾ ਅਤੇ ਵਾਕ ਆਪਸ ਵਿੱਚ ਮਤਲਬ ਬਹੁਤ ਹੀ ਇਹਨਾਂ ਵਿੱਚ ਅੰਤਰ ਹੈ ਜੋ ਵਾਕ ਹੈ ਉਹ ਅਸੀਂ ਡੇਲੀ ਗੱਲਬਾਤ ਵਿੱਚ ਵਰਤਦੇ ਹਾਂ ਅਤੇ ਮੁਹਾਵਰੇ ਜੋ ਕਿ ਇੱਕ ਵੱਡੀ ਗੱਲ ਨੂੰ ਛੋਟਾ ਕਰਕੇ ਸਮਝਾ ਕੇ ਕਿਸੇ ਨੂੰ ਮਤਲਬ ਸਮਝਾਉਣਾ ਹੋਵੇ ਤਾਂ ਤਾਂ ਯੂਜ਼ ਕਰਦੇ ਹਾਂ ਤਾਂ ਵਰਤਦੇ ਹਾਂ